ਤਕਨੀਕੀ ਮੁਸ਼ਕਲਾਂ 'ਚ ਸਭ ਤੋਂ ਵੱਡੀ ਤਕਨੀਕੀ ਅੱਜ ਕੱਲ੍ਹ ਸਾਡੇ ਹੱਥਾਂ 'ਚ ਪਏ ਜਿਹੜੇ ਮੋਬਾਇਲ ਹਨ ਉਹਨਾਂ ਵਿੱਚ ਨਵੀਂ ਤੋਂ ਨਵੀਂ ਚੀਜ਼ ਅਤੇ ਨਵੀਂ ਤੋਂ ਨਵੀਂ ਟੈਕਨੋਲੋਜੀ ਆਉਣ ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਕਈ ਵਾਰ ਆਉਂਦੀ ਹੈ ਅਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਉਹਦੇ ਵਿੱਚ ਲੋਕਾਂ ਦੀ ਮਦਦ ਕਰਦੀ ਹਾਂ ਜਿੱਦਾਂ ਕਿ ਫੋਨ ਨੂੰ ਕਿਸੇ ਖੋਲ੍ਹਣ ਦੇ ਬਹੁਤ ਤਰੀਕੇ ਹੋ ਚੁੱਕੇ ਹਨ ਪਹਿਲੇ ਕਦੀ ਅਸੀਂ ਫੋਨ ਸਿਰਫ ਪਾਸਵਰਡ ਲਾ ਕੇ ਖੋਲ੍ਹਦੇ ਸੀਗੇ ਹੁਣ ਤੁਸੀਂ ਆਪਣੇ ਚਿਹਰੇ ਨਾਲ ਵੀ ਖੋਲ੍ਹ ਸਕਦੇ ਹੋ ਹੱਥਾਂ ਦੀ ਉਗਲਾਂ ਨਾਲ ਵੀ ਖੋਲ੍ਹ ਸਕਦੇ ਹੋ ਪਹਿਲੇ ਸਿਰਫ ਇੱਕ ਅੰਗੂਠਾ ਲਾ ਕੇ ਫੋਨ ਖੋਲ੍ਹਣ ਦੀ ਤਕਨੀਕ ਸੀ ਹੁਣ ਪੰਜ ਉਂਗਲਾਂ ਨੂੰ ਤੁਸੀਂ ਸਕੈਨ ਕਰ ਸਕਦੇ ਹੋ ਅਤੇ ਮੈਂ ਲੋਕਾਂ ਦੀ ਇਹਦੇ ਵਿੱਚ ਮਦਦ ਕਰਦੀ ਹਾਂ ਕਿ ਤੁਸੀਂ ਆਪਣੀ ਸਾਰੀ ਉਂਗਲਾਂ ਨੂੰ ਸਕੈਨ ਕਰਕੇ ਕਿੱਦਾਂ ਇਹਨੂੰ ਖੋਲ੍ਹ ਸਕਦੇ ਹੋ ਟੈਕਨੋਲਜੀ 'ਚ ਫੋਨ ਅੱਜ ਕੱਲ੍ਹ ਉੱਥੇ ਪਹੁੰਚ ਗਏ ਹੈ ਜਿੱਥੇ ਏ ਆਈ ਦਾ ਜ਼ਮਾਨਾ ਆ ਚੁੱਕਾ ਹੈ ਅਤੇ ਉਹਨੂੰ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ ਇੱਥੇ ਜਿੱਥੇ ਉਹਦੇ ਫਾਇਦੇ ਹੈ ਉਸ ਤੋਂ ਜ਼ਿਆਦਾ ਉਸ ਦੇ ਨੁਕਸਾਨ ਵੀ ਹਨ ਦੋਨਾਂ ਦਾ ਧਿਆਨ ਰੱਖਦੇ ਹੋਏ ਟੈਕਨਾਲੋਜੀ ਦੇ ਨਾਲ ਸਮਝਣਾ ਬਹੁਤ ਜ਼ਰੂਰੀ ਹੋ ਚੁੱਕਾ ਹੈ